ਹੈਲੋ ਹਾਂਜੀ ਬੇਟੇ ਕੌਣ ਬੋਲ ਰਹੇ ਹੋ ਹਾਂਜੀ ਬੇਟਾ ਦੱਸੋ ਅੱਛਾ ਬੇਟਾ ਬੇਟੇ ਤੁਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਉ ਠੀਕ ਹੈ ਅਤੇ ਤੁਹਾਡਾ ਜਿਹੜਾ ਮਤਲਬ ਜਿੰਨਾ ਕੁ ਸਿਲੇਬਸ ਤੁਸੀਂ ਕਰਵਾਇਆ ਉਹਦੇ ਤੋਂ ਥੋੜ੍ਹਾ ਜਿਹਾ ਹਾਫ ਕਰਵਾ ਕੇ ਦੇਖ ਲਉ ਕਿ ਉਹ ਬੱਚੇ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਉਹਨੂੰ ਯਾਦ ਕਰ ਸਕਣ ਤਾਂ ਕਿ ਦੇਖੋ ਪੇਰੈਂਟਸ ਸਾਡੇ ਕੋਲ ਬਹੁਤ ਹੀ ਜ਼ਿਆਦਾ ਨਾ ਮਤਲਬ ਵਿਸ਼ਵਾਸ 'ਤੇ ਭੇਜਦੇ ਆ ਕਿ ਇਹ ਸਾਡੇ ਨਾ ਮਤਲਬ ਬੱਚਿਆਂ ਦਾ ਧਿਆਨ ਰੱਖਣਗੇ ਠੀਕ ਹੈ ਉਹ ਇੱਕ ਟੀਚਰ ਨੂੰ ਨਾ ਅਧਿਆਪਕ ਨੂੰ ਇੱਕ ਗੁਰੂ ਸਮਝਦੇ ਆ ਅਤੇ ਅਸੀਂ ਵੀ ਕੁਛ ਉਹਨਾਂ ਦੇ ਪੱਲੇ ਪਾਉਣਾ ਜਾਣੀ ਕਿ ਜਾਣੀ ਕਿ ਉਹ ਯਾਦ ਕਰ ਸਕਣ ਹਾਂਜੀ ਤੁਸੀਂ ਇਸ ਤਰ੍ਹਾਂ ਕਰੋ ਜਾਂ ਤਾਂ ਜਿਵੇਂ ਕਿ ਇੱਕ ਲੈਸਨ ਦੇ ਵਿੱਚ ਅੱਠ ਕੁਸ਼ਚਨ ਆ ਨਾ ਅਤੇ ਤੁਸੀਂ ਇਹਨੂੰ ਚਾਰ ਜਿਹੜੇ ਹੈ ਥੋੜ੍ਹੇ ਛੋਟ ਛੋਟ ਛੋਟੇ ਛੋਟੇ ਕਰਕੇ ਦੇ ਦਿਉ ਤਾਂ ਕਿ ਉਹ ਯਾਦ ਕਰ ਜੇ ਬਹੁਤੀ ਗੱਲ ਆ ਅਗਰ ਉਹ ਚੱਜ ਨਾਲ ਨਹੀਂ ਪੜ੍ਹ ਸਕਦੇ ਤਾਂ ਉਹਨਾਂ ਨੂੰ ਤੁਸੀਂ ਰੀਡਿੰਗ ਦੇ ਤੌਰ 'ਤੇ ਆਪ ਇੱਕ ਇੱਕ ਲਾਈਨ ਪੜ੍ਹ ਪੜ੍ਹ ਕੇ ਨਾ ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਯਾਦ ਕਰਵਾ ਦਿਉ ਤਾਂ ਕਿ ਉਹ ਪੇਪਰ ਵਿੱਚ ਪਾਸ ਹੋ ਜਾਣ ਠੀਕ ਹੈ ਨਾ ਪੇਰੈਂਟਸ ਨੂੰ ਵੀ ਇੱਕ ਆਸ ਬੱਝੇ ਕਿ ਹਾਂ ਮੇਰੇ ਬੱਚੇ ਪਾਸ ਹੋ ਜਾਣਗੇ ਕਿਉਂਕਿ ਸਾਲ ਭਰ ਦੀ ਮਿਹਨਤ ਆ ਤੁਹਾਨੂੰ ਪਤਾ ਹੀ ਆ ਤੁਸੀਂ ਕੋਸ਼ਿਸ਼ ਕਰੋ ਲਾਈਕ ਕਰਨਾ ਅਤੇ ਦੇਖੋ ਆਪਣੇ ਆਪ ਕਰ ਹੀ ਲੈਣਾ ਤੁਸੀਂ ਸਭ ਤੋਂ ਪਹਿਲਾਂ ਜਿਹੜੇ ਬੱਚੇ ਨਹੀਂ ਯਾਦ ਕਰਦੇ ਨਾ ਤੁਸੀਂ ਉਹਨਾਂ ਨੂੰ ਅੱਗੇ ਬਿਠਾਉ ਤਾਂ ਕਿ ਥੋੜ੍ਹਾ ਡਰ ਰਹੇ ਮਾਰਨਾ ਨਹੀਂ ਤੁਸੀਂ ਉਹਨਾਂ ਨੂੰ ਅੱਖ ਦੀ ਅਤੇ ਪਿਆਰ ਵੀ ਕਰੋ ਜਿਹਦੇ ਨਾਲ ਮੋਟੀਵੇਟ ਹੋਏ ਠੀਕ ਹੈ ਠੀਕ ਹੈ ਬੇਟਾ ਹੋਰ ਬੱਚਿਉ ਓਕੇ ਓਕੇ ਬੇਟਾ ਓਕੇ